ਸਾਇੰਸ ਨੇ ਅੱਜ ਬਹੁਤ ਤਰੱਕੀ ਕਰ ਲਈ ਹੈ ਤਕਨਾਲੋਜੀ ਹਰ ਖੇਤਰ ਵਿੱਚ ਪਹੁੰਚ ਗਈ ਆ ਤਕਨਾਲਜੀ ਨੇ ਚਿਕਿਤਸਾ ਵਿੱਚ ਵੀ ਪਹੁੰਚ ਚੁੱਕੀ ਆ ਹਰ ਬਿਮਾਰੀ ਦੇ ਇਲਾਜ ਵਿੱਚ ਟੈਕਨੋਲੋਜੀ ਦਾ ਇਸਤੇਮਾਲ ਹੋ ਰਿਹਾ ਹੈ ਇਹ ਨੇਤਰਹੀਣ ਅਤੇ ਬਜ਼ੁਰਗਾਂ ਨੂੰ ਦੇਖ ਪਾਉਣ ਵਿੱਚ ਵੀ ਮਦਦ ਕਰਦੀ ਆ ਵਿਗਿਆਨਿਕਾਂ ਨੇ ਅ ਤਕਨੋਲਜੀ ਦੀ ਸਹਾਇਤਾ ਨਾਲ ਨੇਤਰਹੀਣਾਂ ਨੂੰ ਅ ਦੁਬਾਰਾ ਦੇਖਣ ਵਿੱਚ ਸਹਾਇਤਾ ਕੀਤੀ ਆ ਜੋ ਕਿ ਨੇਤਰਹੀਣਾਂ ਲਈ ਵਰਦਾਨ ਸਾਬਤ ਹੋਇਆ ਸਕਰੀਨ ਰੀਡਨ ਆਉਂਦਾ ਨਾ ਇੱਕ ਸੋਫਟਵੇਅਰ ਹੈ ਜੋ ਕਿ ਨੇਤਰਹੀਣਾਂ ਨੂੰ ਪੜ੍ਹਨ ਲਿਖਣ ਵਿੱਚ ਸਹਾਇਤਾ ਕਰਦਾ ਹੈ ਇਸ ਐਪਲੀਕੇਸ਼ਨ ਵਿੱਚ ਅਸੀਂ ਲਿਖੇ ਹੋਏ ਅਕਸ਼ਰਾਂ ਨੂੰ ਆਡੀਓ ਵਿੱਚ ਕਨਵਰਟ ਕਰਦੇ ਹੋਏ ਪਾ ਸਕਦੇ ਹਾਂ ਜਿਸ ਨਾਲ ਨੇਤਰਹੀਕਲੋ ਹੀ ਲੋਕ ਨਾ ਸੁਣ ਕੇ ਪਾਠ ਨੂੰ ਸਮਝ ਸਕਦੇ ਨੇ ਇਹ ਇੱਕ ਬਰੇਲੀ ਨਾਮਕ ਡਿਸਪਲੇ ਹੁੰਦਾ ਹੈ ਜਿਹਦੇ ਵਿੱਚ ਅਕਸ਼ਰ ਬਿੰਦੀਆਂ ਦੇ ਰੂਪ ਵਿੱਚ ਜੁੜੇ ਹੁੰਦੇ ਨੇ ਨੇਤਰਹੀਣ ਆਪਣੀ ਉਂਗਲਾਂ ਦੀ ਸਹਾਇਤਾ ਨਾਲ ਉਹਨਾਂ ਨੂੰ ਮਹਿਸੂਸ ਕਰਦੇ ਨੇ ਅਤੇ ਅਕਸ਼ਰ ਸਮਝ ਸਕਦੇ ਆ ਅੱਜ ਕੱਲ੍ਹ ਦੇ ਸਮਾਰਟਫੋਨ ਵਿੱਚ ਵੀ ਅ ਮਾਡਰਨ ਟੈਕਨੋਲੋਜੀ ਆ ਗਈ ਹੈ ਅ ਜਿਸ ਵਿੱਚ ਸਕਰੀਨ ਰੀਡਰਸ ਪਹਿਲਾਂ ਤੋਂ ਹੀ ਹੁੰਦੇ ਨੇ ਨੇਤਰਹੀਣਾਂ ਨੂੰ ਪੜ੍ਹਨ ਵਿੱਚ ਸਹਾਇਤਾ ਕਰਦੇ ਨੇ ਇਹ ਇੱਕ ਬੀ ਮਾਈ ਆਈਜ ਐਪਲੀਕੇਸ਼ਨ ਹੈਗੀ ਹੈ ਜੋ ਨੇਤਰਹੀਣਾਂ ਨੂੰ ਪੜ੍ਹਨ ਵਿੱਚ ਬਹੁਤ ਸਹਾਇਤਾ ਕਰਦੀ ਆ ਇਹ ਐਪਲੀਕੇਸ਼ਨ ਨੇਤਰਹੀਣਾਂ ਵਾਸਤੇ ਵਰਦਾਨ ਸਾਬਤ ਹੋਈ ਹੈ ਜਿਸ ਵਿੱਚ ਉਹ ਨਾ ਸੁਣ ਕੇ ਆਪਣੀ ਸ਼ਿਕਸ਼ਾ ਪ੍ਰਾਪਤ ਕਰ ਸਕਦੇ ਨੇ ਅਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਸਕਦੇ ਨੇ ਧੰਨਵਾਦ